ਸਾਡੇ ਖੇਤਰ ਦੇ ਵਿੱਚ ਹਰ ਇੱਕ ਸਕੂਲ ਕੋਲੇਜ ਅੱਜ ਕੱਲ੍ਹ ਜੋ ਵੀ ਸਕੂਲ ਕੋਲੇਜ ਹੈਗੇ ਨੇ ਉਨ੍ਹਾਂ ਨੇ ਆਪਣਾ ਇੱਕ ਵਿਸ਼ੇ ਸਕੂਲ ਕੋਲੇਜ ਦੇ ਵਿੱਚ ਰੱਖਿਆ ਹੋਇਆ ਹੈ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਕਲਾ ਦਾ ਇੱਕ ਕਿਤਾਬ ਜੋ ਉਨ੍ਹਾਂ ਨੂੰ ਇੱਕ ਸਬਜੈਕਟ ਦੇ ਤੋਰ 'ਤੇ ਸਿਖਾਈ ਜਾਂਦੀ ਹੈਗੀ ਹੈ ਲਗਾਈ ਗਈ ਹੈ ਜਿਹਦੇ ਵਿੱਚ ਬੱਚੇ ਇੱਕ ਕਲਾ ਨੂੰ ਆਪਣਾ ਇੱਕ ਵਿਸ਼ੇ ਦੇ ਰੂਪ ਵਿੱਚ ਸਿੱਖਦੇ ਹਨ ਅਤੇ ਅਲੱਗ ਅਲੱਗ ਪ੍ਰੋਗਰਾਮ ਵੀ ਪੇਸ਼ ਕੀਤੇ ਜਾਂਦੇ ਹਨ ਜਿਹਦੇ ਵਿੱਚ ਕੰਪੀਟੀਸ਼ਨ ਦੇ ਤੋਰ 'ਤੇ ਕਲਾ ਦਾ ਕੰਪੀਟੀਸ਼ਨ ਹੁੰਦਾ ਹੈਗਾ ਜਿਹੜੇ ਬਾਹਰੋਂ ਵੀ ਆਉਂਦੇ ਹਨ ਕੰਪਨੀਆਂ ਵਾਲੇ ਅਤੇ ਆਪਾਂ ਸਕੂਲ ਵੱਲੋਂ ਵੀ ਇੱਕ ਕੋਈ ਵੀ ਕੰਪੀਟੀਸ਼ਨ ਹੁੰਦਾ ਹੈਗਾ ਪ੍ਰਤੀਯੋਗਤਾ ਹੁੰਦੀ ਹੈ ਜਿਹਦੇ ਵਿੱਚ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ